ਪੰਜ ਜਨਵਰੀ ਉੱਨੀ ਸੌ ਪਚਾਨਵੇਂ ਸੱਤ ਦਸੰਬਰ ਉੱਨੀ ਸੌ ਤ੍ਰਿਆਨਵੇਂ ਦੋ ਜਨਵਰੀ ਉੱਨੀ ਸੌ ਪੈਂਹਠ ਸੱਤ ਸਤੰਬਰ ਉੱਨੀ ਸੌ ਨੜਿਨਵੇਂ ਅੱਠ ਅਗਸਤ ਦੋ ਹਜ਼ਾਰ ਇੱਕ